ਚਾਹ ਬਣਾਉ ਅਸੀਂ ਘਰ ਵਿੱਚ ਚਾਹ ਬਣਾਉਣ ਲਈ ਸਭ ਤੋਂ ਪਹਿਲਾਂ ਪੈਨ ਚੁੱਕਦੇ ਹਾਂ ਅਤੇ ਫਿਰ ਉਸ ਵਿੱਚ ਪਾਣੀ ਪਾਉਂਦੇ ਹਾਂ ਅਤੇ ਉਸਨੂੰ ਗੈਸ ਔਨ ਕਰਕੇ ਉਸਦੇ ਉੱਪਰ ਰੱਖਦੇ ਹਾਂ ਫਿਰ ਉਸ ਵਿੱਚ ਚਾਹ ਪੱਤੀ ਪਾਉਂਦੇ ਹਾਂ ਅਤੇ ਆਪਣੇ ਸੁਆਦ ਦੇ ਅਨੁਸਾਰ ਲੌਂਗ ਇਲਾਇਚੀ